ਭੰਗੜਾ ਐਰੋਬਿ ਐਰੋਬਿਕਸ ਦੀ ਕੋਰੋਗ੍ਰਾਫੀ ਬਣਾਉਣ ਦੇ ਲਈ ਸਾਰੇ ਸਟੈਪ ਨੂੰ ਸੰਕਲਿਤ ਕਰਨਾ ਪੈਂਦਾ ਹੈ ਜੋ ਸਰੀਰ ਨੂੰ ਫਿੱਟ ਅਤੇ ਐਨਰਜੀ ਵਾਲਾ ਰੱਖਦਾ ਹੈ ਇਸ ਲਈ ਕੁਛ ਮਨੋਰੰਜ ਅਤੇ ਮਨੋਰੰਜਕ ਵੀ ਹੋਣਾ ਚਾਹੀਦਾ ਹੈ ਜਿਵੇਂ ਕਿ ਤੁਰਾਂ ਦੀ ਪੈਰਾਂ ਦੀ ਲਹਿਰ ਬਣਾਉਣੀ ਪੈਂਦੀ ਹੈ ਔਰ ਮਿਊਜਿਕ ਅਤੇ ਧੁਨ ਦੀ ਚੋਣ ਕਰਨੀ ਪੈਂਦੀ ਹੈ ਭੰਗੜਾ ਐਰੋਬਿਕ ਐਰੋਬਿਕਸ ਵਿੱਚ ਮਿਊਜਿਕ ਦਾ ਰੋਲ ਬਹੁਤ ਜ਼ਿਆਦਾ ਹੁੰਦਾ ਹੈ ਜਿਵੇਂ ਕਿ ਮਤਲਬ ਮਿਊਜਿਕ ਦੇ ਹਿਸਾਬ ਨਾਲ ਹੀ ਸਟੈਪ ਬਣਾਉਣੇ ਪੈਂਦੇ ਹੈ ਅਤੇ ਇਹਦੇ ਵਿੱਚ ਸਰੀਰ ਦੇ ਹਰ ਇੱਕ ਹਿੱਸੇ ਨੂੰ ਵਰਤਣਾ ਪੈਂਦਾ ਹੈ ਹਰੇਕ ਕਦਮ ਨੂੰ ਲੰਬੇ ਰੱਖਣਾ ਜਿਵੇਂ ਕਿ ਅਤੇ ਸਰੀਰ ਦੇ ਹਰ ਹਿੱਸੇ ਜਿਵੇਂ ਕਿ ਹੱਥ ਪੈਰ ਵਗੈਰਾ ਦੀ ਮੁਮੈਂਟ ਨੂੰ ਸ਼ਾਮਲ ਕਰਨਾ ਪੈਂਦਾ ਹੈ ਅਤੇ ਕੁਛ ਸਟੈਪ ਇਹੋ ਜਿਹੇ ਵੀ ਹੁੰਦੇ ਹੈ ਜਿਹਦੇ ਵਿੱਚ ਤੁਰਨ ਫਿ ਤੁਰਨ ਨਾਲ ਜੁੜੇ ਹੋਣ ਅਤੇ ਵੱਖ ਵੱਖ ਪੈਰਾਂ ਦੀ ਸਥਿਤੀ ਬਣਾਉਣੀ ਹੁੰਦੀ ਹੈ ਅਤੇ ਵਾਰੀ ਵਾਰੀ ਰਿਅਸਲ ਕਰਨੀ ਮਤਲਬ ਹਰੇਕ ਸਟੈਪ ਦੀ ਅੱਛੀ ਤਰ੍ਹਾਂ ਰਿਅਸਲ ਕਰਨੀ ਸਾਰੇ ਪਾਰਟੀਸਪੈਂਟ ਦਾ ਆਪਸ ਵਿੱਚ ਕੋਰਡੀਨੇਟ ਕਰਨਾ ਉਨ੍ਹਾਂ ਨੂੰ ਉਨ੍ਹਾਂ ਦਾ ਤਾਲਮੇਲ ਬਣਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਕੋਰੀਓਗ੍ਰਾਫੀ ਕਰਨ ਵੇਲੇ ਇਹ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਸਾਰੇ ਬਰਾਬਰ ਸਟੈਪ ਕਰਨ ਸਾਰੇ ਮਤਲਬ ਜ ਜਿੰਨੇ ਵੀ ਆਪਾਂ ਭੰਗੜਾ ਕਰ ਰਹੇ ਹਾਂ ਉਨ੍ਹਾਂ ਦੀ ਮਤਲਬ ਸਾਰਿਆਂ ਦੀ ਤਾਲਮੇਲ ਵਧੀਆ ਹੋਵੇ ਆਪਸ 'ਚ ਅਤੇ ਖੁਦ ਨੂੰ ਮਤਲਬ ਪੂਰੀ ਤਰ੍ਹਾਂ ਉਹਦੇ ਵਿੱਚ ਇਨਵੋਲਵ ਕਰਨਾ ਗ ਮਿਊਜਿਕ ਨੂੰ ਅੱਛੀ ਤਰ੍ਹਾਂ ਸੁਣਨਾ ਅਤੇ ਉਸਦੇ ਹਿਸਾਬ ਨਾਲ ਫਿਰ ਸਟੈਪ ਕਰਨਾ ਪੂਰਾ ਆਪਣਾ ਫੋਕਸ ਉੱਥੇ ਹੀ ਰੱਖਣਾ ਚਾਹੀਦਾ ਹੈ ਇਸ ਇਸ ਤਰ੍ਹਾਂ ਆਪਾਂ ਨੂੰ ਇਹਦੀ ਜਿਹੜੀ ਸਾਰੀ ਕੋਰੀਓਗ੍ਰਾਫੀ ਹੈ ਇਹ ਕਰਨੀ ਪੈਂਦੀ ਹੈ